ਮੈਂ ਇੱਕ ਇਲੈਕਟਰੋਨਿਕ ਆਈਡਮ ਔਡਰ ਕੀਤੀ ਹੈ ਔਨਲਾਈਨ ਜੋ ਕਿ ਹੈ ਲੈਪਟੋਪ ਅਤੇ ਉਸ ਦੀ ਡਿਲੀਵਰੀ ਬਹੁਤ ਫਾਸਟ ਸੀ ਅਤੇ ਉਸ 'ਤੇ ਜੋ ਮੈਂ ਔਨਲਾਈਨ ਮੰਗਾਇਆ ਅਤੇ ਉਸ ਦੀ ਸਰਵਿਸ ਵੀ ਬਹੁਤ ਵਧੀਆ ਸੀ ਅਤੇ ਜੋ ਲੈਪਟਾਪ ਆਇਆ ਉਹ ਉਸ ਦੀ ਪੈਕਿੰਗ ਬਹੁਤ ਹੀ ਵਧੀਆ ਹੈ ਅਤੇ ਉਹ ਪੂਰਾ ਪੈਕਡ ਸੀਲਡ ਆਇਆ ਹੈ ਅਤੇ ਉਹ ਕਿਸੇ ਵੀ ਜਗ੍ਹਾ ਤੋਂ ਡਿਫੈਕਟ ਹੈ ਨਹੀਂ ਹੈ ਅਤੇ ਉਸ ਦੇ ਨਾਲ ਮੈਨੂੰ ਇੱਕ ਬੈਗ ਫਰੀ ਮਿਲਿਆ ਹੈ ਅਤੇ ਹੈਡਫੋਨ ਅਤੇ ਉਸ ਦਾ ਚਾਰਜਰ ਲੈਪਟਾਪ ਦਾ ਉਹ ਵੀ ਬਹੁਤ ਵਧੀਆ ਹੈ ਉਸ ਦੀ ਪਰਫੋਰਮੈਂਸ ਬੈਟਰੀ ਬੈਕਅਪ ਅਤੇ ਉਸ ਦੀ ਡਿਸਪਲੇ ਕੁਆਲਿਟੀ ਵੀ ਬਹੁਤ ਵਧੀਆ ਹੈ ਇਹ ਲੈਪਟੋਪ ਮੈਂ ਐੱਚ ਪੀ ਓਮੇਨ ਦਾ ਔਡਰ ਕੀਤਾ ਜੋ ਕਿ ਮੈਨੂੰ ਇੱਕ ਲੱਖ ਇੱਕ ਲੱਖ ਸਮਥਿੰਗ ਕੁਝ 'ਚ ਪਿਆ ਹੈ ਅਤੇ ਉਸ ਦੀ ਸਟੋਰੇਜ ਵੀ ਬਹੁਤ ਵਧੀਆ ਹੈ ਅਤੇ ਉਸ ਦਾ ਪ੍ਰੋਸੈਸਰ ਏ ਐਮ ਡੀ ਰਾਈਸਨ ਸੇਵਿਨ ਓਕਟਾ ਕੋਰ ਹੈ ਅਤੇ ਉਸ ਦੀ ਰੈਮ ਵੀ ਸੋਲਾਂ ਜੀ ਬੀ ਹੈ ਉਸ ਵਿੱਚ ਅਸੀਂ ਬਹੁਤ ਕੁਝ ਸਟੋਰ ਕਰ ਸਕਦੇ ਹਾਂ ਅਤੇ ਉਸ ਦੀ ਅ ਅਤੇ ਉਸ ਵਿੱਚ ਐਸ ਐਸ ਸਟੋਰੇਜ ਵੀ ਹੈ ਜੋ ਕਿ ਇੱਕ ਟੀ ਬੀ ਹੈ ਜੋ ਉਸ ਦਾ ਆਪਰੇਟਿੰਗ ਸਿਸਟਮ ਹੈ ਉਹ ਵਿੰਡੋ ਇਲੈਵਨ ਵਾਲਾ ਹੈ ਅਤੇ ਉਸ ਦੀ ਵੇਟ ਅਤੇ ਡਮੈਨਸ਼ਨਸ ਬਹੁਤ ਵਧੀਆ ਹੈ ਅਤੇ ਉਸ 'ਚ ਐਡੀਸ਼ਨਲ ਫੀਚਰ ਵੀ ਹਨ ਜਿਹਦੇ ਵਿੱਚ ਬਲੈਕਇਟ ਕੀਬੋਰਡ ਹੈ ਟੱਚ ਸਕਰੀਨ ਹੈ ਫਿੰਗਰ ਪ੍ਰਿੰਟ ਰੀਡਰ ਹੈ ਅਤੇ ਸਾਨੂੰ ਉਸ ਵਿੱਚ ਇੱਕ ਸਾਲ ਦੀ ਵਾਰੰਟੀ ਵੀ ਦਿੱਤੀ ਗਈ ਹੈ ਅਤੇ ਉਸ ਦੀ ਸਕਰੀਨ ਸਾਈਜ਼ ਹੈ ਸੋਲਾਂ ਪੁਆਇੰਟ ਇੱਕ ਇੰਚ ਅਤੇ ਉਸ ਦੀ ਡਿਸਪਲੇ ਫੁੱਲ ਐਚ ਡੀ ਡਿਸਪਲੇ ਆ ਅਤੇ ਇਹ ਸਾਨੂੰ ਬਹੁਤ ਹੀ ਵਧੀਆ ਲੱਗਿਆ ਹੈ ਅਤੇ ਅਸੀਂ ਇਸ ਚੀਜ਼ ਨਾਲ ਬਹੁਤ ਹੀ ਖੁਸ਼ ਹਨ ਕਿ ਅਸੀਂ ਜੋ ਆਰਡਰ ਕੀਤਾ ਹੈ ਉਹ ਸਾਨੂੰ ਇੱਕਦਮ ਸਹੀ ਅਤੇ ਬਿਨਾਂ ਡਿਫੈਕਟ ਵਾਲੀ ਚੀਜ਼ ਮਿਲ ਗਈ ਹੈ ਇਸ ਦੇ ਵਿੱਚ ਗ੍ਰਾਫਿਕ ਕਾਰਡਸ ਵੀ ਹਨ ਜੋ ਕਿ ਸਾਨੂੰ ਜੀ ਪੀ ਯੂ ਮਾਡਲ ਔਰ ਮੈਮਰੀ ਆਡੈਂਟੀਫਾਈ ਕਰਦੇ ਹਨ